ਮੋਹਾਲੀ ਜ਼ਿਲ੍ਹਾ ਇੱਕ ਵਿਕਾਸਸ਼ੀਲ ਜ਼ਿਲ੍ਹਾ ਹੈ ਵਿਕਾਸਸ਼ੀਲ ਜ਼ਿਲ੍ਹਾ ਹੋਣ ਕਰਕੇ ਉਰੇ ਆਬਾਦੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਬਾਕੀ ਜ਼ਿਲ੍ਹਿਆਂ ਦੇ ਲੋਕ ਉਰੇ ਆ ਕੇ ਕਾਰੋਬਾਰ ਲੱਭਦੇ ਹਨ ਅਤੇ ਉਰੇ ਹੀ ਰਹਿੰਦੇ ਹਨ ਕੁਦਰਤੀ ਸ੍ਰੋਤਾਂ ਦੀ ਗੱਲ ਕੀਤੀ ਜਾਵੇ ਤਾਂ ਉਰੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜ਼ਿਆਦਾਤਰ ਘਰਾਂ ਵਿੱਚ ਲੋਕ ਸਮਰਸੀਬਲ ਯੂਜ਼ ਕਰਦੇ ਹਨ ਜੰਗਲ ਉਰੇ ਬਹੁਤ ਹੀ ਘੱਟ ਹਨ ਕਿਉਂਕਿ ਉਰੇ ਜੰਗਲ ਕੱਟ ਕੇ ਪਹਿਲਾਂ ਹੀ ਫਲੈਟ ਅਤੇ ਘਰ ਬਣਾ ਲਏ ਗਏ ਹਨ ਪ੍ਰਦੂਸ਼ਣ ਦੀ ਗੱਲ ਕੀਤੀ ਜਾਵੇ ਤਾਂ ਹਵਾ ਪ੍ਰਦੂਸ਼ਣ ਉਰੇ ਦਾ ਮੁੱਖ ਸ੍ਰੋਤ ਹੈ ਕਿਉਂਕਿ ਘਰ ਘਰ ਵਿੱਚ ਗੱਡੀਆਂ ਮੋਟਰਸਾਈਕਲ ਹੋਣ ਕਰਕੇ ਹਰੇਕ ਕੋਲ ਆਪਣਾ ਸਾਧਨ ਹੈ ਜਿਸ ਕਰਕੇ ਹਵਾ ਪ੍ਰਦੂਸ਼ਣ ਵਿੱਚ ਬਹੁਤ ਹੀ ਵਾਧਾ ਪਾਇਆ ਜਾਂਦਾ ਹੈ ਜੇਕਰ ਆਪਾਂ ਉਰੇ ਦੀ ਸਫ਼ਾਈ ਦੀ ਗੱਲ ਕੀਤੀ ਜਾਵੇ ਤਾਂ ਨਗਰਪਾਲਿਕਾ ਉਰੇ ਟਾਈਮ ਟਾਈਮ 'ਤੇ ਸਫ਼ਾਈ ਕਰਵਾਉਂਦੀ ਰਹਿੰਦੀ ਹੈ ਜਿਸ ਕਰਕੇ ਇਹ ਇੱਕ ਬਹੁਤ ਜ਼ਿਆਦਾ ਸਾਫ਼ ਸੁਥਰਾ ਜ਼ਿਲ੍ਹਾ ਹੈ